ਜਿਵੇਂ ਕਈ ਹੱਦ ਤੱਕ ਤਾਂ ਮੇਰੀਆਂ ਪੇਂਟਿੰਗਾਂ ਬਹੁਤ ਬੈਟਰ ਨੇ ਪਰ ਉਹਨਾਂ ਨੂੰ ਮੈਂ ਹੋਰ ਬਿਹਤਰ ਬਣਾਉਣਾ ਚਾਹੁੰਦੀ ਹਾਂ ਜਿਵੇਂ ਡੇਲੀ ਦੇ ਘੱਟੋ ਘੱਟ ਆਪਾਂ ਨੂੰ ਮਤਲਬ ਕੋਈ ਇੱਕ ਪਰਟੀਕੁਲਰਲੀ ਇੱਕ ਪੇਂਟਿੰਗ ਬਣਾਉਣ 'ਚ ਕਮ ਸੇ ਕਮ ਦੋ ਘੰਟੇ ਲੱਗਦੇ ਅਤੇ ਜ਼ਿਆਦਾ ਤੋਂ ਜ਼ਿਆਦਾ ਤਾਂ ਕਿੰਨਾ ਵੀ ਲੱਗਦਾ ਉਸਨੂੰ ਫਿਨਿਸ਼ਿੰਗ ਦੇਣਾ ਵਧੀਆ ਜੇ ਡੇਲੀ ਦੀ ਆਪਾਂ ਜਾਂ ਦੋ ਦਿਨ 'ਚ ਜੇ ਆਪਾਂ ਕੋਈ ਕਿਸੇ ਇੱਕ ਪੈਂਟਿੰਗ ਨੂੰ ਵੀ ਵਧੀਆ ਬਣਾਉਂਦੇ ਹਾਂ ਹੈ ਨਾ ਤਾਂ ਵਧੀਆ ਇੱਕ ਪ੍ਰੈਕਟਿਸ ਇੱਕ ਵਧੀਆ ਫਿਨਿਸ਼ਿੰਗ ਆਊਗੀ ਇੱਕ ਸ਼ੇਡਿੰਗਸ ਹੋ ਗਈਆਂ ਜਿਵੇਂ ਕਿ ਪੇਂਟ ਬਰੱਸ਼ਿਸ਼ ਨੂੰ ਕਿਵੇਂ ਯੂਜ ਕਰਨਾ ਪੇਂਟਸ ਨੂੰ ਕਿਵੇਂ ਫੜਨਾ ਮਤਲਬ ਪੇਂਟ ਬ੍ਰਸ਼ਿਸ਼ ਨੂੰ ਕਿਵੇਂ ਫੜਨਾ ਹੈ ਨਾ ਪੇਟ ਨੂੰ ਕਿਸ ਤਰੀਕੇ ਨਾਲ ਯੂਜ ਕਰਨਾ ਮਿਨੀਮਮ ਅਮਾਊਂਟ ਆਫ ਹੈ ਨਾ ਪੇਂਟ ਯੂਜ ਕਰਨਾ ਤਾਂ ਉਸ ਤਰੀਕੇ ਨਾਲ ਵਧੀਆ ਪੇਂਟਿੰਗਜ਼ ਨੂੰ ਆਕਾਰ ਦੇਣਾ ਬਣਾਉਣਾ ਪੇਂਟਿੰਗਜ਼ ਨੂੰ ਤਾਂ ਜਿਵੇਂ ਜਿਵੇਂ ਜੇ ਮੈਂ ਡੇਲੀ ਦਾ ਪ੍ਰੈਕਟਿਸ ਕਰੂੰਗੀ ਪੇਟਿੰਗ ਨੂੰ ਡੇਲੀ ਬਰੱਸ਼ ਫੜੂੰਗੀ ਹੱਥ ਜੇ ਮੈਂ ਬਰੱਸ਼ ਹੀ ਨਹੀਂ ਫੜਨਾ ਆਉਂਦਾ ਮੈਨੂੰ ਤਾਂ ਫਿਰ ਤਾਂ ਪੇਂਟਿੰਗ ਕਿਵੇਂ ਕਰਨੀ ਕਿ ਜੇ ਮੈਂ ਡੇਲੀ ਪੇਂਟਿੰਗ ਨੂੰ ਹੋਰ ਬਿਹਤਰ ਬਣਾਉਣਾ ਚਾਹੁੰਦੀ ਹਾਂ ਤਾਂ ਮੈਨੂੰ ਜਿਹੜੀ ਪੇਂਟਿੰਗ ਹੈ ਉਸ ਨੂੰ ਆਪਣੀ ਡੇਲੀ ਦੇ ਲਾਈਫ ਸਟਾਈਲ ਵਿੱਚ ਉਹਨੂੰ ਐਡ ਕਰਨਾ ਹੈ ਨਾ ਬਹੁਤ ਜ਼ਰੂਰੀ ਆ ਅਤੇ ਜੇ ਮੈਂ ਵਧੀਆ ਦੋ ਦਿਨ 'ਚ ਵੀ ਜੇ ਮੈਂ ਕਿਸੇ ਇੱਕ ਪੇਂਟਿੰਗ ਨੂੰ ਵੀ ਇੱਕ ਬਿਹਤਰ ਤਰੀਕੇ ਨਾਲ ਬਣਾ ਸਕਦੀ ਹਾਂ ਤਾਂ ਉਹਦੇ ਨਾਲ ਮੇਰੀ ਬਹੁਤ ਬਿਹਤਰ ਬਣ ਸਕਦੀ ਹੈ ਪੇਂਟਿੰਗ ਹੈ ਨਾ ਅਤੇ ਜੇ ਐਵੇਂ ਡੇਲੀ ਡੇਲੀ ਮੈਂ ਕਰੀ ਜਾਊਂਗੀ ਜੇ ਮੇਰੀ ਅੱਜ ਵਧੀਆ ਨਹੀਂ ਹੈਗੀ ਆ ਜੇ ਅੱਜ ਮੈਂ ਸਹੀ ਨਹੀਂ ਕਰ ਪਾ ਰਹੀ ਹਾਂ ਤਾਂ ਕੱਲ੍ਹ ਨੂੰ ਇੱਕ ਦਿਨ ਐਵੇਂ ਦਾ ਵੀ ਆਊਗਾ ਕਿ ਮੈਂ ਉਸਨੂੰ ਵਧੀਆ ਐਜ਼ ਅ ਸ਼ੇਡ ਵਧੀਆ ਪੇਂਟ ਕਲਰਸ ਨਾਲ ਉਹਨੂੰ ਵਧੀਆ ਕਲਰਫੁਲ ਬਣਾਊਂਗੀ ਹੈ ਨਾ ਤਾਂ ਜਿੰਨਾ ਮੈਂ ਉਸਨੂੰ ਪ੍ਰੈਕਟਿਸ ਕਰੂੰਗੀ ਜਾਂ ਜਿੰਨਾ ਮੈਂ ਬ੍ਰਸ਼ਿਸ ਨੂੰ ਫੜੂੰਗੀ ਜਾਂ ਬ੍ਰਸ਼ ਸਪੀਡ ਪ੍ਰੈਸ਼ਰਸ ਨੂੰ ਫੜੂੰਗੀ ਓਨਾ ਹੀ ਮੇਰੀ ਪੇਂਟਿੰਗ ਜਿਹੜੀ ਹੈ ਉਹ ਬਿਹਤਰ ਬਣੂਗੀ ਹੈ ਨਾ ਜਿਵੇਂ ਜਿਵੇਂ ਮੈਂ ਜਿੰਨਾ ਜਾਣੂ ਹੋਊਂਗੀ ਕਲਰਸ ਤੋਂ ਓਨਾ ਹੋਰ ਜਿਵੇਂ ਕਿ ਮੇਰੇ ਕੋਲ ਜਿਵੇਂ ਪੈਂਸਿਲ ਸ਼ੇਡਿੰਗਸ ਵਗੈਰਾ ਵੀ ਹੋ ਗਈਆਂ ਆਪਣੀਆਂ ਉਹਦੇ ਵਿੱਚ ਵੀ ਜੇ ਮੈਂ ਅਲੱਗ ਅਲੱਗ ਪੈਸਿਲਸ ਅਤੇ ਸ਼ੇਡ ਨੂੰ ਪਹਿਚਾਣੂਗੀ ਕਿ ਹਾਂ ਬਈ ਇਹ ਲਾਈਟ ਸ਼ੇਡ ਵਾਸਤੇ ਯੂਜ ਕਰਨੀ ਆ ਇਹ ਡਾਰਕ ਵਾਸਤੇ ਯੂਜ ਕਰਨੀ ਆ ਇਹ ਗੂੜ੍ਹਾ ਰੰਗ ਕਰਦੀ ਆ ਇਹ ਫਿੱਕਾ ਰੰਗ ਕਰਦੀ ਆ ਉਸ ਤਰੀਕੇ ਨਾਲ ਪੈਨਸਿਲ ਨੂੰ ਵੀ ਫੜਨ ਦਾ ਤਰੀਕਾ ਕੀ ਹੋਣਾ ਚਾਹੀਦਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਜੇ ਮੈਂ ਇੱਕ ਸਟੈਪ ਵਾਈਜ ਸਟੈਪ ਜੇ ਮੈਂ ਪ੍ਰੈਕਟਿਸ ਕਰੂੰਗੀ ਉਹਨਾਂ ਦੀ ਜੇ ਮੈਂ ਡੇਲੀ ਲਾਈਫ 'ਚ ਆਪਾਂ ਨੂੰ ਐਡ ਕਰੂੰਗੀ ਡਰਾਇੰਗ ਨੂੰ ਪੇਟਿੰਗ ਨੂੰ ਤਾਂ ਮੇਰੀ ਵਧੀਆ ਜਿਹੜੀ ਪੇਂਟਿੰਗਸ ਹੈ ਵਧੀਆ ਨਿੱਖਰਦੀ ਜਾਊਗੀ ਹੋਰ ਸਾਫ ਹੁੰਦੀ ਜਾਊਗੀ ਫਿਰ ਇੱਕ ਟਾਈਮ ਐਵੇਂ ਦਾ ਆਊਗਾ ਵਧੀਆ ਪ੍ਰੋਫੈਸ਼ਨਲ ਤੌਰ 'ਤੇ ਮੈਂ ਬਹੁਤ ਸੋਹਣੀ ਪੇਂਟਿੰਗਸ ਬਣਾਊਂਗੀ ਅਤੇ ਜੇ ਮੈਂ ਪੇਂਟਿੰਗਸ ਵਿੱਚ ਛੱਡਤੀ ਤਾਂ ਫਿਰ ਤਾਂ ਮੇਰੀ ਜਿਹੜੀ ਹੈ ਉਹ ਪੇਟਿੰਗ ਵਧੀਆ ਬਣਨੀ ਨਹੀਂ ਇਸ ਕਰਕੇ ਮੈਨੂੰ ਪੇਂਟਿੰਗ ਨੂੰ ਲਗਾਤਾਰ ਰੱਖਣਾ ਪਊਗਾ ਮਤਲਬ ਕੁਛ ਨਾ ਕੁਛ ਮੈਨੂੰ ਕਰਨਾ ਚਾ ਕਰਨਾ ਹੀ ਰਹਿੰਦਾ ਜਾਊਗਾ ਕਿ ਮੈਂ ਵਧੀਆ ਕਰੀ ਜਾਵਾਂ ਅਤੇ ਵਧੀਆ ਮੇਰਾ ਹੋਈ ਜਾਵੇ ਕੰਮ